ਅੱਜ ਕੱਲ੍ਹ ਦਾ ਵਿਆਹ ਲਾੜੀ ਨੂੰ ਸ਼ਗਨ ਦੇ ਤੌਰ 'ਤੇ ਜਿਸ ਤਰ੍ਹਾਂ ਸੂਟ ਅਤੇ ਗਹਿਣੇ ਦਿੱਤੇ ਜਾਂਦੇ ਹਨ ਵੀ ਇਹ ਵਿਆਹ ਵਿੱਚ ਲਾੜੀ ਦੇ ਜੋ ਕਰੀਬੀ ਰਿਸ਼ਤੇਦਾਰ ਅਤੇ ਜਿਸ ਤਰ੍ਹਾਂ ਉਸਦੇ ਨਾਨਕੇ ਮਾਮੇ ਜੋ ਨਾਨਕਾ ਪਰਿਵਾਰ ਹੁੰਦਾ ਹੈ ਉਸ ਵੱਲੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਬਣਾ ਕੇ ਝਾਂਜਰਾਂ ਅਤੇ ਟਿੱਕੇ ਬਣਾ ਕੇ ਦਿੱਤੇ ਜਾਂਦੇ ਹਨ ਅਤੇ ਅਤੇ ਨਾਨਕਿਆਂ ਦੇ ਪਰਿਵਾਰ ਵੱਲੋਂ ਜਿਸ ਤਰ੍ਹਾਂ ਫਰਨੀਚਰ ਪੇਟੀ ਅਲਮਾਰੀ ਸੋਫਾ ਸੈੱਟ ਅਤੇ ਬੈੱਡ ਅਤੇ ਹੋਰ ਵੀ ਵਸਤਾਂ ਦਾਜ ਦੇ ਰੂਪ ਵਿੱਚ ਦਿੱਤੀਆਂ ਜਾਂਦੀਆਂ ਹਨ ਇਹ ਦਾਜ ਪ੍ਰਥਾ ਬਹੁਤ ਹੀ ਮਾੜੀ ਚੀਜ਼ ਹੈ ਜੋ ਕਿ ਨਹੀਂ ਲੈਣਾ ਚਾਹੀਦਾ ਜੋ ਕਿ ਹੋਣੀ ਨਹੀਂ ਚਾਹੀਦੀ ਪਰ ਕੁੱਲ ਮਿਲਾ ਕੇ ਇਸਦਾ ਰਿਜ਼ਲਟ ਇਹ ਨਿਕਲਦਾ ਹੈ ਕਿ ਦਾਜ ਤਾਂ ਦਿੱਤਾ ਜਾਂਦਾ ਹੈ ਪਰ ਇਹ ਵੀ ਸੱਚ ਹੈ ਕਿ ਅੱਜ ਕੱਲ੍ਹ ਕੁਝ ਇਲਾਕੇ ਪੜ੍ਹੇ ਲਿਖੇ ਹੋਣ ਕਰਕੇ ਕੁੜੀਆਂ ਅਤੇ ਮੁੰਡੇ ਵਧੀਆ ਪੜ੍ਹੇ ਲਿਖੇ ਹੋਣ ਕਰਕੇ ਜੋ ਦਾਜ ਹੈ ਦਾਜ ਵੱਲੋਂ ਲੋਕ ਮੁੜ ਕੇ ਆਪਣੇ ਬੱਚਿਆਂ ਨੂੰ ਬਿਨਾਂ ਦਾਜ ਤੋਂ ਵੀ ਵਿਆਉਣ ਲੱਗੇ ਹਨ ਪਰ ਜ਼ਿਆਦਾਤਰ ਲੋਕ ਦਾਜ ਲੈਣਾ ਅਤੇ ਦੇਣਾ ਪਸੰਦ ਕਰਦੇ ਹਨ ਦਾਜ ਦੇ ਨਾਲ ਜੋ ਲੜਕੀ ਲਾੜੀ ਵਾਲਾ ਪਰਿਵਾਰ ਹੈ ਉਸ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਉਸ ਨੂੰ ਕਰਜ਼ਾ ਚੁੱਕ ਕੇ ਇਹ ਦਾਜ ਦੇਣਾ ਪੈਂਦਾ ਹੈ ਜੇਕਰ ਇਸ 'ਤੇ ਕੋਈ ਵੀ ਐਕਸ਼ਨ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਇਸ ਦਾਜ ਦੀ ਪ੍ਰਥਾ ਨੂੰ ਬੰਦ ਕਰਨਾ ਚਾਹੀਦਾ ਹੈ ਇਸ 'ਤੇ ਕੋਈ ਵਧੀਆ ਕਾਨੂੰਨ ਬਣਨਾ ਚਾਹੀਦਾ ਹੈ ਪਰ ਇਸ ਦਾ ਤੱਤ ਇਹ ਕੱਢਿਆ ਹੈ ਕਿ ਨੱਬੇ ਪ੍ਰਸੈਂਟ ਜਵਾਬ ਇਸਦਾ ਇਹ ਹੈ ਕਿ ਲੋਕ ਦਾਜ ਦਿੰਦੇ ਹਨ ਅਤੇ ਲੋਕ ਦਾਜ ਲੈਂਦੇ ਵੀ ਹਨ